ਸਤਿ ਸ਼੍ਰੀ ਅਕਾਲ ਅੱਜ ਮੈਂ ਕਿਸੇ ਇਹੋ ਜਿਹੀ ਚੀਜ਼ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਜੋ ਹਰ ਰੋਜ਼ ਜ਼ਿੰਦਗੀ ਨੂੰ ਬਦਲ ਰਹੀ ਹੈ ਟੈਕਨੋਲੋਜੀ ਤਕਨੋਲਜੀ ਸਿਰਫ ਨੌਜਵਾਨ ਪੀੜ੍ਹੀ ਲਈ ਜ਼ਰੂਰੀ ਨਹੀਂ ਹੈ ਪਰ ਇਹ ਬਜ਼ੁਰਗਾਂ ਅਤੇ ਦ੍ਰਿਸ਼ਟੀਹੀਨ ਵਿਅਕਤੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਤਕਨੋਲੋਜੀ ਬਜ਼ੁਰਗਾਂ ਦੀ ਮਦਦ ਕਰਦੀ ਹੈ ਕਿਵੇਂ ਕਰਦੀ ਹੈ ਅੱਜ ਅਸੀਂ ਦੇਖਦੇ ਹਾਂ ਸਮਾਰਟ ਵਾਚ ਅਤੇ ਪਹਿਨਣ ਯੋਗ ਉਪਕਰਨ ਦਿਲ ਦੀ ਧੜਕਨ ਬਲੱਡ ਪ੍ਰੈਸ਼ਰ ਨੂੰ ਟਰੈਕ ਕਰਦੇ ਹਨ ਅਤੇ ਡਿੱਗਣ ਦਾ ਪਤਾ ਵੀ ਲਗਾਉਂਦੇ ਹਨ ਜੇ ਕੋਈ ਵਿਅਕਤੀ ਡਿੱਗ ਜਾਂਦਾ ਹੈ ਤਾਂ ਇਹ ਉਪਕਰਣ ਆਪਣੇ ਆਪ ਪਰਿਵਾਰਿਕ ਮੈਂਬਰਾਂ ਜਾਂ ਐਮਰਜੈਂਸੀ ਸੇਵਾਵਾਂ ਨੂੰ ਸੁਚੇਤ ਕਰਦੀਆਂ ਹਨ ਟੈਲੀ ਮੈਡੀਸਨ ਰਾਹੀਂ ਬਜ਼ੁਰਗ ਡਾਕਟਰਾਂ ਨਾਲ ਆਨਲਾਈਨ ਸਲਾਹ ਮਸ਼ਵਰਾ ਕਰਨ ਸਕਦੇ ਹਨ ਜਿਸ ਨਾਲ ਹਸਪਤਾਲ ਦੀ ਯਾਤਰਾ ਕਰਨ ਦੀ ਜ਼ਰੂਰਤ ਘੱਟ ਜਾਂਦੀ ਹੈ ਸਮਾਰਟ ਫੋਨ ਅਤੇ ਵੀਡੀਓ ਕਾਲਿੰਗ ਐਪਸ ਬਜ਼ੁਰਗ ਵਿਅਕਤੀਆਂ ਨੂੰ ਪਰਿਵਾਰ ਅਤੇ ਦੋਸਤਾਂ ਨਾਲ ਜੁੜੇ ਰਹਿਣ ਵਿੱਚ ਮਦਦ ਕਰਦੇ ਹਨ ਜਿਸ ਨਾਲ ਉਹਨਾਂ ਦਾ ਇਕੱਲਾਪਨ ਘੱਟ ਜਾਂਦਾ ਹੈ ਤਕਨੋਲੋਜੀ ਦ੍ਰਿਸ਼ਟੀਹੀਨ ਲੋਕਾਂ ਨੂੰ ਵੀ ਬਹੁਤ ਮਦਦ ਕਰਦੀ ਹੈ ਜਿਵੇਂ ਕਿ ਬਰੇਲ ਕੀ ਕਿਤਾਬਾਂ ਅਤੇ ਡਿਸਪਲੇ ਦ੍ਰਿਸ਼ਟੀਹੀਨ ਉਪਭੋਗਤਾ ਨੂੰ ਟੱਚ ਰਾਹੀਂ ਡਿਜੀਟਲ ਸਮੱਗਰੀ ਪੜ੍ਹਨ ਵਿੱਚ ਮਦਦ ਕਰਦੇ ਹਨ ਵਾਇਸ ਅਸਿਸਟੈਂਟ ਦ੍ਰਿਸ਼ਟੀਹੀਨ ਲੋਕਾਂ ਨੂੰ ਸੁਨੇਹੇ ਭੇਜਣ ਕਾਲ ਕਰਨ ਜਾਂ ਸਿਰਫ ਬੋਲ ਕੇ ਇੰਟਰਨੈਟ ਦੀ ਖੋਜ ਕਰਨ ਦੀ ਆਗਿਆ ਦਿੰਦੇ ਹਨ ਏ ਆਈ ਅਤੇ ਵੀ ਮਾਈ ਆਈਜ਼ ਵਰਗੀਆਂ ਐਪਸ ਦ੍ਰਿਸ਼ਟੀਹੀਨ ਲੋਕਾਂ ਨੂੰ ਵਸਤੂਆਂ ਨੂੰ ਪਛਾਨਣ ਲਿਖਣ ਪੜ੍ਹਨ ਅਤੇ ਇਥੋਂ ਤੱਕ ਕਿ ਆਰਟੀਫਿਸ਼ਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਆਲੇ ਦੁਆਲੇ ਦਾ ਵਰਨਨ ਕਰਨ ਵਿੱਚ ਵੀ ਮਦਦ ਕਰਦੀਆਂ ਹਨ ਸੋ ਟੈਕਨੋਲੋਜੀ ਸਿਰਫ ਨਵੀਨਤਾ ਬਾਰੇ ਨਹੀਂ ਹੈ ਇਹ ਸ਼ਮੂਲੀਅਤ ਬਾਰੇ ਹੈ ਇਹ ਬਜ਼ੁਰਗ ਵਿਅਕਤੀਆਂ ਨੂੰ ਸੁਤੰਤਰ ਤੌਰ 'ਤੇ ਰਹਿਣ ਵਿੱਚ ਮਦਦ ਕਰਦਾ ਹੈ ਅਤੇ ਦ੍ਰਿਸ਼ਟੀਹੀਣ ਲੋਕਾਂ ਨੂੰ ਸੰਸਾਰ ਤੱਕ ਵਧੇਰੇ ਪਹੁੰਚ ਪ੍ਰਦਾਨ ਕਰਦਾ ਹੈ